ਬਚਪਨ ਸਾਡੀ ਜ਼ਿੰਦਗੀ ਦਾ ਬਹੁਤ ਹੀ ਪਿਆਰਾ ਹਿੱਸਾ ਹੁੰਦਾ ਹੈ ਬਚਪਨ ਦੀਆਂ ਸਾਡੀਆਂ ਸਭ ਦੀਆਂ ਬਹੁਤ ਹੀ ਮਨਮੋਹਕ ਯਾਦਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਅਸੀਂ ਸਾਰਿਆਂ ਨੇ ਕੁਛ ਨਾ ਕੁਛ ਸ਼ਰਾਰਤਾਂ ਕੋਈ ਨਾ ਕੋਈ ਗਲਤੀਆਂ ਕੁਛ ਬੜੇ ਹਾਸੇ ਖੇਡੇ ਵਾਲੇ ਪਲ ਗੁਜ਼ਾਰੇ ਹੁੰਦੇ ਹਨ ਉਨ੍ਹਾਂ ਵਿੱਚ ਅਸੀਂ ਹਮੇਸ਼ਾਂ ਹੀ ਆਪਣੀ ਮਨਮਰਜੀਆਂ ਕਰਦੇ ਹਾਂ ਕੀ ਸਾਡੇ ਲਈ ਸਹੀ ਹੈ ਕੀ ਗਲਤ ਹੈ ਇਹ ਸਾਨੂੰ ਸਾਡੇ ਪਰਿਵਾਰ ਵਾਲੇ ਦੱਸਦੇ ਹਨ ਅਸੀਂ ਬਚਪਨ ਵਿੱਚ ਆਪਣੀ ਦਾਦਾ ਦਾਦੀਆਂ ਤੋਂ ਬਹੁਤ ਸਾਰੀਆਂ ਕਹਾਣੀਆਂ ਸੁਣਦੇ ਹਾਂ ਜੋ ਕਿ ਸਾਨੂੰ ਸ਼ਿਕਸ਼ਾ ਦਿੰਦੀਆਂ ਹਨ ਕਿ ਜ਼ਿੰਦਗੀ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ ਕਿਵੇਂ ਕਿਹੜੀ ਚੀਜ਼ ਸਹੀ ਹੁੰਦੀ ਹੈ ਕਿਵੇਂ ਕਿਹੜੀ ਚੀਜ਼ ਗਲਤ ਇਹ ਸਾਡੇ ਪਰਿਵਾਰ ਵੱਲੋਂ ਸਾਨੂੰ ਬਚਪਨ 'ਚ ਸਿਖਾਈ ਜਾਂਦੀ ਹੈ ਬਚਪਨ 'ਚ ਅਸੀਂ ਬਹੁਤ ਹੀ ਬੇਪਰਵਾਹ ਹੋ ਕੇ ਘੁੰਮਦੇ ਹਾਂ ਸਾਨੂੰ ਕਿਸੇ ਚੀਜ਼ ਦੀ ਕੋਈ ਵੀ ਪਰਵਾਹ ਨਹੀਂ ਹੁੰਦੀ ਕਿ ਕਿਹੜੀ ਚੀਜ਼ ਕਿਵੇਂ ਬਣਦੀ ਹੈ ਕਿਵੇਂ ਉਸ ਚੀਜ਼ ਨੂੰ ਪਾਉਣ ਲਈ ਸਾਨੂੰ ਪਰੀਸ਼੍ਰਮ ਕਰਨਾ ਪੈਂਦਾ ਹੈ ਬਸ ਸਾਨੂੰ ਜੋ ਵੀ ਚਾਹੀਦਾ ਹੁੰਦਾ ਹੈ ਅਸੀਂ ਆਪਣੇ ਘਰਦਿਆਂ ਨੂੰ ਕਹਿੰਦੇ ਹਾਂ ਅਤੇ ਸਾਨੂੰ ਉਹ ਚੀਜ਼ ਮਿਲ ਜਾਂਦੀ ਹੈ ਜਿਹੜੀ ਚੀਜ਼ ਨਹੀਂ ਵੀ ਮਿਲਦੀ ਤਾਂ ਬਚਪਨ ਵਿੱਚ ਸਾਡੀ ਜਿੱਦ ਵੀ ਪੁਗਾ ਦਿੱਤੀ ਜਾਂਦੀ ਹੈ ਜੋ ਕਿ ਸਾਡੇ ਘਰਦਿਆਂ ਦਾ ਪਿਆਰ ਹੁੰਦਾ ਹੈ ਬਚਪਨ 'ਚ ਅਸੀਂ ਸਭ ਦੇ ਬਹੁਤ ਲਾਡਲੇ ਹੁੰਦੇ ਹਾਂ ਸਾਨੂੰ ਸਾਰੇ ਬਹੁਤ ਹੀ ਪਿਆਰ ਕਰਦੇ ਹਨ ਅਤੇ ਅਸੀਂ ਸਾਰਿਆਂ ਨਾਲ ਬਹੁਤ ਸਾਰਾ ਪਿਆਰ ਕਰਦੇ ਹਾਂ ਸਾਡੇ ਲਈ ਕੀ ਸਹੀ ਹੈ ਕੀ ਗਲਤ ਹੈ ਇਹ ਸਾਨੂੰ ਸਾਡੇ ਘਰਵਾਲੇ ਦਾਦਾ ਦਾਦੀ ਔਰ ਵੱਡਿਆਂ ਤੋਂ ਸਿੱਖਣ ਨੂੰ ਮਿਲਦਾ ਹੈ ਧੰਨਵਾਦ